ਚਿੱਤਰਕਾਰੀ ਕਰਨੀ ਬਹੁਤ ਹੀ ਵਧੀਆ ਕਲਾ ਤੇ ਮੈਂ ਤਾ ਇਹਨੂੰ ਕੋਂਗਰੈਕਚੁਲੇਟ ਕਰਨੀ ਆ ਕਿ ਤੂੰ ਇਹ ਸਪੈਸ਼ਲ ਨੂੰ ਕਰਨ ਬਾਰੇ ਸੋਚਿਆ ਇਹ ਕੋਈ ਸੌਖੀ ਚੀਜ਼ ਨਹੀਂ ਇਹ ਕਰਨ ਵਾਸਤੇ ਪਰ ਜੇ ਤੂੰ ਰੈਗੂਲਰ ਪ੍ਰੈਕਟਿਸ ਕਰੇਗਾ ਤਾਂ ਤੇਰੇ ਵਾਸਤੇ ਬਹੁਤ ਹੀ ਵਧੀਆ ਰਹੇਗੀ ਐ ਚੀਜ਼ ਹੋਲੀ ਹੋਲੀ ਕਰਕੇ ਤੂੰ ਰੰਗਾਂ ਦੀ ਪਹਿਚਾਨ ਕਰ ਤੂੰ ਮਾਰਕਰ ਯੂਸ ਕਰ ਤੂੰ ਐਕਸਪੈਰੀਮੈਂਟ ਕਰ ਦੂਜਿਆਂ ਰੰਗਾਂ ਨਾਲ ਜਿਸ ਕਾਰਨ ਤੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤੇਰੀਆਂ ਚੀਜ਼ਾਂ ਸੁਧਰਨਗੀਆਂ ਤੇ ਸਾਰਿਆਂ ਤੋਂ ਜਰੂਰੀ ਚੀਜ਼ ਜੇ ਤੂੰ ਆਪਦੇ ਕੰਮ ਵਿੱਚ ਜਿਆਦਾ ਅੱਗੇ ਵੱਧਦਾ ਚਾਹੁਨਾ ਤਾਂ ਫਿਰ ਤੂੰ ਛੋਟੀ ਛੋਟੀ ਆਪਦੇ ਗੋਲ ਸੈਟ ਕਰ ਪਹਿਲਾ ਦਿਨ ਚ ਪੰਦਰਾਂ ਤੋਂ ਤੀਹ ਮਿੰਟ ਉਸ ਤੋਂ ਬਾਅਦ ਇਕ ਘੰਟਾ ਦੋ ਘੰਟੇ ਫਿਰ ਤੇਰਾ ਪੈਸ਼ਨ ਹੀ ਬਣ ਜੂਗਾ ਤੇਰੀ ਡਰਾਇੰਗ ਦੇ ਨਾਲ ਹੀ ਤੋ ਰੈਗੂਲਰ ਪ੍ਰੈਕਟਿਸ ਵੀ ਕਰਨੀ ਐ ਐਸ ਚੀਜ਼ ਦੀ ਕੁਝ ਫੰਡਾਮੈਂਟਲ ਰੂਲਸ ਰੈਗੂਲੇਸ਼ਨ ਹੁੰਦੇ ਐ ਕੀ ਕਿ ਜਿਵੇਂ ਆਪਾਂ ਨੂੰ ਮਾਪਨਾ ਆਉਣਾ ਚਾਹੀਦਾ ਕਿ ਕਿੰਨੇ ਕਿਹੜੀਆਂ ਚੀਜ਼ਾਂ ਨੂੰ ਕਿਹੜੇ ਕਿਹੜੇ ਭਾਗਾਂ ਦੇ ਵਿੱਚ ਆਪਾਂ ਡਿਵਾਈਡ ਕਰਨਾ ਤੇ ਉਸ ਤੋਂ ਨਾਲ ਜੇ ਕਦੇ ਤੇਰੇ ਕੋਲੋਂ ਕੋਈ ਗਲਤੀ ਵੀ ਹੋ ਜੇ ਤਾਂ ਤੂੰ ਪਰੇਸ਼ਾਨ ਬਿਲਕੁਲ ਵੀ ਨਹੀਂ ਹੋਣਾ ਕਿਉਂਕਿ ਐਵਾ ਐਵੇਂ ਕਿਹਾ ਜਾਂਦਾ ਕੀ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤੇ ਗਲਤੀਆਂ ਹੀ ਆਦਮੀ ਨੂੰ ਸੁਧਾਰ ਦੀਆ ਹਨ ਤੇ ਜੇ ਕਦੇ ਕੋਈ ਗਲਤੀ ਹੋ ਵੀ ਜੇ ਤਾਂ ਕਦੇ ਵੀ ਨਿਰਾਸ਼ ਨਹੀਂ ਹੋਣਾ ਇਸ ਤੋਂ ਇਲਾਵਾ ਤੋਂ ਵੱਖਰੇ ਵੱਖਰੇ ਡਰਾਇੰਗ ਬੁੱਕਸ ਦਾ ਯੂਜ ਕਰ ਜਿੰਦਾ ਜੋ ਵੇਖ ਕੇ ਤੂੰ ਡਰਾਇੰਗ ਕਰ ਸਕੇ ਤੇ ਜਦੋਂ ਤੂੰ ਮਾਸਟਰ ਸਕਿਲ ਇਹਨਦੀ ਲੈ ਲਵੇ ਤਾਂ ਉਸ ਤੋਂ ਬਾਅਦ ਉਹ ਵਾਤਾਵਰਨ ਦੀ ਚਿੱਤਰਕਾਰੀ ਵੀ ਕਰ ਤੇ ਲੋੜ ਪੈਣ ਤੇ ਕੋਸ਼ਿਸ਼ ਵੀ ਜੁਆਇਨ ਕਰ ਲੈ ਤਾਂ ਤੇਰਾ ਹੱਥ ਖੁੱਲ ਜੇ ਤੇ ਵਧੀਆ ਵਧੀਆ ਹੋਰ ਤਕਨੀਕਾਂ ਬਣਨ ਤੇ ਬਾਕੀ ਬਹੁਤ ਬਹੁਤ ਕੋਂਗਰੈਕਚੁਲੇਸ਼ਨ ਤੇ ਰੱਬ ਕਰੇ ਕਿ ਤੇਰਾ ਕੰਮ ਬਹੁਤ ਹੀ ਅੱਗੇ ਨੂੰ ਵਧੇ ਤੇ ਤੇਰੀ ਦਿਲਚਸਪੀ ਹੋਰ ਇਹਦੇ ਚ ਵਧੇ